ਪੰਜਾਬ ਦੀਆਂ ਪ੍ਰਮੁੱਖ ਖੇਡਾਂ ਮਸ਼ਹੂਰ ਵਿੱਚੋਂ ਇੱਕ ਖੇਡ ਆਉਂਦੀ ਹੈ ਜਿਹੜੀ ਸਾਰੇ ਦੌੜ ਹੈ ਦੌੜ ਵਿੱਚ ਫ਼ੌਜਾ ਸਿੰਘ ਦਾ ਸਭ ਤੋਂ ਵੱਧ ਪ੍ਰਸ਼ੰਸਾਯੋਗ ਵਾਲੀ ਗੱਲ ਹੈ ਕਿਉਂਕਿ ਉਹ ਦੁਨੀਆ ਦਾ ਸਭ ਤੋਂ ਬਜ਼ੁਰਗ ਅਤੇ ਲੰਬੀ ਦੌੜ ਤੈਅ ਕਰਨ ਵਾਲਾ ਸੀ ਜਿਨ੍ਹਾਂ ਨੇ ਨੱਬੇ ਸਾਲ ਦੀ ਉਮਰ ਤੋਂ ਲੈ ਕੇ ਸੌ ਸਾਲ ਦੀ ਉਮਰ ਤੱਕ ਛੱਬੀ ਮੀਲ ਦੀ ਦੌੜ ਤੈਅ ਕੀਤੀ ਹੈ ਜੋ ਕਿ ਪੰਜ ਘੰਟੇ ਅਤੇ ਚਾਲੀ ਮਿੰਟ ਵਿੱਚ ਉਨ੍ਹਾਂ ਨੇ ਪੂਰੀ ਕੀਤੀ ਹੈ ਦੂਜੀ ਹੁੰਦੀ ਹੈ ਨਿਸ਼ਾਨੇਬਾਜ਼ੀ ਖੇਡ ਦੇਸ਼ ਨੂੰ ਪਹਿਲਾ ਓਲੰਪਿਕਾ ਕੋਟਾ ਦਿਵਾਉਣ ਵਾਲੀ ਪੰਜਾਬ ਦੀ ਕੁੜੀ ਦਾ ਨਾਂ ਅਨੁਚਿਤ ਮੋਦੀ ਗਿੱਲ ਹੈ ਕੁੜੀ ਨੇ ਵਧੀਆ ਖੇਡ ਕੇ ਅਰਜਨ ਅਵਾਰਡ ਵੀ ਜਿੱਤਿਆ ਹੈ ਅਤੇ ਫੇਰ ਗੱਲ ਆਉਂਦੀ ਹੈ ਹੋਕੀ ਖੇਡ ਦੀ ਮਨਦੀਪ ਸਿੰਘ ਦਾ ਨਾਂ ਪਹਿਲਾਂ ਲਿਆ ਜਾਂਦਾ ਹੈ ਜਿਨ੍ਹਾਂ ਨੇ ਸੌਲ੍ਹਾਂ ਦਸੰਬਰ ਦੋ ਹਜ਼ਾਰ ਬਾਰ੍ਹਾਂ ਨੂੰ ਹਾਕੀ ਇੰਡੀਆ ਟੀਮ ਲਈ ਪਹਿਲਾ ਨਿਲਾਮੀ ਖੇਡ ਵਿੱਚ ਜੇਤੂ ਬਣੇ ਅਤੇ ਹੁਣ ਗੱਲ ਆਉਂਦੀ ਹੈ ਕ੍ਰਿਕਟ ਖੇਡ ਦੀ ਜੋ ਕਿ ਲੋਕਾਂ ਲਈ ਬੜੀ ਪਸੰਦ ਕਰਦੇ ਹਨ ਇਸ ਵਿੱਚ ਹਰਭਜਨ ਸਿੰਘ ਦਾ ਨਾਂ ਆਉਂ ਜ਼ਿਆਦਾ ਆਉਂਦਾ ਹੈ ਪੰਜਾਬ ਲਈ ਨਾਈਟੀਨ ਨਾਈਨਟੀ ਏਟ ਤੋਂ ਦੋ ਹਜ਼ਾਰ ਸੌਲ੍ਹਾਂ ਤੱਕ ਔਫ਼ ਸਪਿੰਨ ਗੇਂਦਬਾਜ਼ ਵਜੋਂ ਖੇਡਿਆ ਗਿਆ ਸਭ ਤੋਂ ਵਧੀਆ ਸਪਿਨਿੰਗ ਗੇਂਦਬਾਜ਼ ਵਿੱਚ ਇੱਕ ਮੰਨਿਆ ਜਾਂਦਾ ਹੈ ਇਹ ਦੋ ਹਜ਼ਾਰ ਸੱਤ ਅਤੇ ਦੋ ਹਜ਼ਾਰ ਗਿਆਰਾਂ ਵਿੱਚ ਵਿਸ ਕ੍ਰਿਕਟ ਮੈਚ ਵਿੱਚ ਵੀ ਜਿੱਤਣ ਵਾਲੀ ਟੀਮ ਰਹੀ ਹਰਭਜਨ ਸਿੰਘ ਕ੍ਰਿਕਟ ਨਾਲ ਕ੍ਰਿਕਟ ਦੇ ਨਾਲ ਨਾਲ ਫ਼ਿਲਮ ਸੈਲੀਬ੍ਰਿਟੀ ਅਤੇ ਐਕਟਰ ਦੇ ਰੂਪ ਵਿੱਚ ਵੀ ਦੇਖੇ ਜਾਂਦੇ ਹਨ ਸਰਕਾਰ ਨੇ ਇਨ੍ਹਾਂ ਦਾ ਵਧੀਆ ਵਿਵਹਾਰ ਦੇਖ ਕੇ ਇਨ੍ਹਾਂ ਨੂੰ ਡੀ ਸੀ ਪੀ ਦਾ ਵੀ ਰੈੱਕ ਦਿੱਤਾ ਹੈ ਥੈਂਕ ਯੂ